ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਔਰ ਇੱਥੇ ਵੱਖ ਵੱਖ ਕਿਸਮ ਦੀਆਂ ਫ਼ਸਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ ਪਰ ਅੱਜ ਕੱਲ੍ਹ ਜਿਵੇਂ ਕਿ ਨਵੀਂ ਪੀੜ੍ਹੀ ਜੋ ਕਿ ਖੇਤੀ ਕਰਨਾ ਨਹੀਂ ਚਾਹੁੰਦੀ ਅਤੇ ਸਰਕਾਰ ਵੀ ਸਾਨੂੰ ਆਪਣੀ ਖੇਤੀ ਦਾ ਸਹੀ ਮੁੱਲ ਨਹੀਂ ਦੇ ਰਹੀ ਇਸ ਕਰਕੇ ਅੱਜ ਕੱਲ੍ਹ ਜੋ ਨਵੇਂ ਬੱਚੇ ਹਨ ਉਹ ਆਪਣੇ ਖੇਤ ਪੈਲੀਆਂ ਵੇਚ ਕੇ ਬਾਹਰ ਜਾਈ ਜਾਂਦੇ ਹਨ ਔਰ ਖੇਤੀ ਦੀ ਉਲਝਣ ਵਿੱਚ ਪੈਣਾ ਨਹੀਂ ਚਾਹੁੰਦੇ ਔਰ ਇਹ ਬਹੁਤ ਹੀ ਮਾੜੀ ਗੱਲ ਹੈ ਸਾਡੀਆਂ ਸਰਕਾਰਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਔਰ ਸਾਨੂੰ ਖੇਤੀ ਵਿੱਚ ਭਿੰਨਤਾ ਲਿਆਉਣ ਦੀ ਜ਼ਰੂਰਤ ਹੈ ਇਸ ਬਾਰੇ ਸਰਕਾਰ ਸਾਡੀ ਮਦਦ ਕਰੇ ਤਾਂ ਅਸੀਂ ਖੇਤੀਬਾੜੀ ਵਿੱਚ ਭਿੰਨਤਾ ਲਿਆ ਸਕਦੇ ਹਾਂ ਬਾਕੀ ਅਸੀਂ ਤਾਂ ਪੁਰਾਣੇ ਸਮੇਂ ਤੋਂ ਖੇਤੀ ਕਰ ਰਹੇ ਹਾਂ ਔਰ ਸਾਨੂੰ ਇਸ ਦੀ ਮਹੱਤਤਾ ਬਾਰੇ ਪ ਪਤਾ ਹੈ ਔਰ ਖੇਤੀਬਾੜੀ ਜ਼ਰੂਰ ਕਰਨੀ ਚਾਹੀਦੀ ਹੈ